ਮੈਂ ਪੰਜਾ ਆਪਣੀ ਕਿਤਾਬ ਪੰਜਾਬ ਪੰਜਾਬ ਦੇ ਵਿਸ਼ੇ 'ਤੇ ਲਿਖਣੀ ਚਾਹੁੰਦਾ ਹਾਂ ਪੰਜਾਬ ਲਿਖਣੀ ਚਾਹੁੰਦਾ ਪੰਜਾਬੀ ਵਿੱਚ ਹੀ ਲਿਖਣੀ ਚਾਹੁੰਦਾ ਹਾਂ ਵਾ ਪੰਜਾਬੀ ਮੈਨੂੰ ਸਭ ਤੋਂ ਪੰਜਾਬੀ ਵਿੱਚ ਲਿਖਣਾ ਬਹੁਤ ਹੀ ਵਧੀਆ ਲੱਗਦਾ ਹੈ ਪੰਜਾਬ ਦੇ ਹਾਲਾਤਾਂ ਨੂੰ ਵਰਣਨ ਕਰਦੇ ਹੋਏ ਮੈਂ ਉਹਦੇ ਵਿੱਚ ਕੁਝ ਕੁ ਲਾਈਨਾਂ ਲਿਖ ਚੁੱਕਾ ਹਾਂ ਅਤੇ ਅੱਗੇ ਹੋਰ ਲਿਖਣਾ ਚਾਹੁੰਦਾ ਹਾਂ ਪੰਜਾਬ 'ਤੇ ਜਦੋਂ ਕੋਈ ਵੀ ਦੁੱਖ ਕੋਈ ਵੀ ਤਕਲੀਫ ਆਉਂਦੀ ਹੈ ਤਾਂ ਪੰਜਾਬ ਦੇ ਨਾਲ਼ ਕੋਈ ਸਹਾਈ ਨਹੀਂ ਹੁੰਦਾ ਹੁਣ ਹੜ੍ਹ ਆਏ ਸੀ ਤਾਂ ਪੰਜਾਬ ਨਾਲ਼ ਕੋਈ ਨਹੀਂ ਖੜ੍ਹਿਆ ਪੰਜਾਬ ਆਪਣੇ ਪੰਜਾਬ ਦੇ ਪੁੱਤਰ ਪੰਜਾਬ ਦੇ ਮੁੰਡੇ ਕੁੜੀਆਂ ਬਜ਼ੁਰਗ ਕੋਈ ਵੀ ਸੰਸਥਾਵਾਂ ਪੰਜਾਬ ਦੀਆਂ ਇੱਕ ਦੂਜੇ ਲਈ ਸਹਾਈ ਹੋਏ ਹਾਂ ਜਦੋਂ ਵੀ ਕਿਸੇ ਵੀ ਹੋਰ ਦੇਸ਼ ਲਾ ਲਉ ਭਾਰਤ ਵਿੱਚ ਲਾ ਲਉ ਕਿਤੇ ਵੀ ਬਾਹਰ ਲਾ ਲਉ ਤਾਂ ਪੰਜਾਬ ਦੀ ਇੱਕ ਸੰਸਥਾ ਖਾਲਸਾ ਏਡ ਭਾਈ ਰਵਿੰਦਰ ਸਿੰਘ ਨੇ ਬਣਾਈ ਜਿਹੜੀ ਉਹ ਹਰ ਜਗ੍ਹਾ ਜਾ ਕੇ ਆਪਣਾ ਸਹਾਇਤਾ ਕਰਦੀ ਹੈ ਲੋਕਾਂ ਦੀ ਮਦਦ ਕਰਦੀ ਹੈ ਪਰ ਪੰਜਾਬ ਲਈ ਕੋਈ ਵੀ ਨਹੀਂ ਖੜ੍ਹਦਾ ਪੂਰੇ ਭਾਰਤ ਵਿੱਚੋਂ ਅਤੇ ਪੰਜਾਬ ਸਿਰਫ ਆਪਣੇ ਆਪ ਲਈ ਖੜ੍ਹਾ ਹੈ ਅਤੇ ਜਦੋਂ ਪੰਜਾਬ ਹੱਕਾਂ ਲਈ ਲੜਦਾ ਹੈ ਤਾਂ ਉਹਨੂੰ ਅੱਤਵਾਦੀ ਕਹਿਣ ਲੱਗ ਜਾਂਦੇ ਨੇ ਪੰਜਾਬ ਦੀ ਕਿਸਾਨਾਂ ਨਾਲ਼ ਵੀ ਬੜਾ ਧੱਕਾ ਹੁੰਦਾ ਹੈ ਜਦੋਂ ਦੋ ਹਜ਼ਾਰ ਬਾਈ ਵ ਵੀਹ ਦੇ ਵਿੱਚ ਪਾਸ ਹੋਏ ਸੀ ਬਿੱਲ ਪਾਸ ਹੋਏ ਸੀ ਕਿਸਾਨੀ ਧਰਨੇ ਦਾ ਪੰਜਾਬ ਪੂਰੇ ਜੋਸ਼ ਨਾਲ਼ ਖੜ੍ਹ ਗਿਆ ਜਾ ਕੇ ਅਤੇ ਉਹਦੇ ਨਾਲ਼ ਹਰਿਆਣਾ ਜ਼ਰੂਰ ਖੜ੍ਹਿਆ ਸੀ ਉਦ ਹਰਿਆਣੇ ਦੇ ਲੋਕ ਵੀ ਪੰਜਾਬ 'ਚੋਂ ਹੀ ਨਿਕਲੇ ਹਨ ਇ ਲਈ ਇ ਇਸ ਹਲਾਤਾਂ ਨੂੰ ਦੇਖਦੇ ਹੋਏ ਪੰਜਾਬ 'ਤੇ ਹੋਰ ਅੱਗੇ ਅੱਗੇ ਲਿਖਣਾ ਚਾਹੁੰਦਾ ਹਾਂ ਅਤੇ ਪੰਜਾਬ 'ਤੇ ਪੰਜਾਬੀ ਵਿੱਚ ਲਿਖਣਾ ਵੀ ਮੈਨੂੰ ਵ